ਸਾਡੇ ਖੇਤਰ ਵਿੱਚ ਰਿਵਾਇਤੀ ਖੇਡਾਂ ਬਹੁਤ ਹਨ ਜਿਵੇਂ ਕਿ ਬਾਸਕਿਟਬੋਲ ਬੈਡਮਿੰਟਨ ਖੋ ਖੋ ਕ੍ਰਿਕਟ ਵਰਗੀਆਂ ਖੋ ਖੋ ਵਿੱਚ ਬਹੁਤ ਜਾਣੇ ਖੇਡਦੇ ਹਨ ਲਾਈਕ ਗਿਆਰਾਂ ਤੋਂ ਬਾਰਾਂ ਜਾਣੇ ਖੇਡਦੇ ਹਨ ਜਿਸ ਨਾਲ ਉਹਨਾਂ ਦਾ ਮਾਈਂਡ ਵੀ ਟਿਕਿਆ ਰਹਿੰਦਾ ਹੈ ਕਦੀ ਵੀ ਬ ਵਾਰੀ ਆ ਸਕਦੀ ਹੈ ਕਦੀ ਵੀ ਫੜਨਾ ਪੈ ਸਕਦਾ ਵਾ ਭੱਜਣਾ ਪੈ ਸਕਦਾ ਵਾ ਇਸ ਨਾਲ ਬਹੁਤ ਫਾਇਦੇ ਹੁੰਦੇ ਹਨ ਕਿ ਸਾਡੀ ਸਟਰੈਂਥ ਵਧੀ ਰਹਿੰਦੀ ਹੈ ਸਾਡਾ ਮਾਈਂਡ ਵੀ ਡਿਵਰਟ ਨਹੀਂ ਹੁੰਦਾ ਇੱਕੋ ਹੀ ਜਗ੍ਹਾ ਲੱਗਿਆ ਰਹਿੰਦਾ ਵਾ ਸਾਨੂੰ ਸ਼ ਹੋਰ ਵੀ ਸਟਰੈਂਥ ਸਾਡੀ ਵੱਧਦੀ ਰਹਿੰਦੀ ਹੈ ਔਰ ਬਾਸਕਿਟਬੋਲ ਵਿੱਚ ਵੀ ਸੇਮ ਆ ਸਾਡੀ ਸਟਰੈਂਥ ਹਾਈਟ ਸਭ ਕੁਛ ਬਹੁਤ ਵਧੀਆ ਤਰ੍ਹਾਂ ਵਧਦਾ ਹੈਗਾ ਵਾ ਅਤੇ ਸਾਡਾ ਮਾਈਂਡ ਵੀ ਡਿਵਰਟ ਨਹੀਂ ਹੁੰਦਾ ਇੱਕੋ ਹੀ ਜਗ੍ਹਾ ਲੱਗਾ ਰਹਿੰਦਾ ਸਾਨੂੰ ਪਤਾ ਹੁੰਦਾ ਆਪਣਾ ਗੋਲ ਕੀ ਹੈਗਾ ਵਾ ਅਤੇ ਉਹ ਹੀ ਆਪਾਂ ਅੱਗੇ ਜਾਰੀ ਰੱਖਦੇ ਹਨ ਕ੍ਰਿਕਟ ਵਿੱਚ ਕੀ ਹੈ ਬੋਲਿੰਗ ਕਰਦੇ ਹਾਂ ਔਰ ਬੈਟਿੰਗ ਕਰਦੇ ਹੈਗੇ ਹਾਂ ਉਨ੍ਹਾਂ ਵਿੱਚ ਵੀ ਮਾਈਂਡ ਸਾਡਾ ਇਹ ਹੀ ਫ਼ਾਇਦਾ ਹੈਗਾ ਵਾ ਕਿ ਮਾਈਂਡ ਸਾਡਾ ਟਿਕਿਆ ਰਹਿੰਦਾ ਵਾ ਸਾਡਾ ਡਿਵਰਟ ਨਹੀਂ ਹੁੰਦਾ ਕਿਸੇ ਪਾਸੇ ਔਰ ਬੈਡਮਿੰਟਨ ਮੇਰੀ ਫੇਵਰਟ ਹੈਗੀ ਆ ਜਿਸ ਵਿੱਚ ਆਪਾਂ ਬੈਡਮਿੰਟਨ ਖੇਡੀ ਦੀ ਆ ਚਿੜੀ ਹੁੰਦੀ ਆ ਉਸ ਨੂੰ ਆਪਾਂ ਇੱਕ ਦੂਜੇ ਵੱਲ ਮਾਰੀ ਦਾ ਵਾ ਸਕੋਰਸ ਬਣਾਈ ਦੇ ਹਨ ਅਤੇ ਉਸ ਨਾਲ ਵੀ ਸਾਡਾ ਮਾਈਂਡ ਡਿਵਰਟ ਨਹੀਂ ਹੁੰਦਾ ਇੱਕੋ ਹੀ ਪਾਸੇ ਲੱਗਾ ਰਹਿੰਦਾ ਸਾਨੂੰ ਪਤਾ ਹੁੰਦਾ ਕਿਤੋਂ ਵੀ ਆ ਸਕਦੀ ਆ ਕਿਤੇ ਵੀ ਆ ਸਕਦੀ ਹੈਗੀ ਕੋਈ ਵੀ ਜਗ੍ਹਾ 'ਤੇ ਆਪਾਂ ਨੂੰ ਜਾਣਾ ਪੈ ਸਕਦਾ ਵਾ ਭੱਜ ਕੇ ਅਤੇ ਇਸ ਨਾਲ ਸਾਡੀ ਸਟਰੈਂਥ ਬਹੁਤ ਵਧੀਆ ਰਹਿੰਦੀ ਹੈਗੀ ਆ ਔਰ ਹਾਈਟ ਵੀ ਵੱਧਦੀ ਹੈਗੀ ਆ ਕੁੜੀਆਂ ਲਈ ਅਤੇ ਬੈਡਮਿੰਟਨ ਬਹੁਤ ਵਧੀਆ ਸੋਰਸ ਹੈਗਾ ਵਾ ਜਿਸ ਨਾਲ ਸਾਡੀ ਹੈਲਥ ਵੀ ਮਨਟੇਨ ਰਹਿੰਦੀ ਆ ਫਿਜ਼ੀਕਲੀ ਵੀ ਔਰ ਮੈਂਟਲੀ ਵੀ ਸਾਰੀਆਂ ਗੇਮਾਂ ਲਈ ਫਾਇਦੇ ਇਹ ਹੀ ਹਨ ਕਿ ਸਾਡਾ ਫਿਜ਼ੀਕਲ ਔਰ ਮੈਂਟਲ ਦੋਵੇਂ ਹੀ ਸਹੀ ਰਹਿੰਦਾ ਫਿਜ਼ੀਕਲੀ ਵੀ ਬੰਦਾ ਸਹੀ ਰਹਿੰਦਾ ਵਾ ਅਤੇ ਮੈਂਟਲੀ ਵੀ ਸਹੀ ਰਹਿੰਦਾ